ਬਾਗਬਾਨੀ ਸਾਡੇ ਪਰਿਵਾਰ 'ਚ ਸਾਰੇ ਹੀ ਸ਼ ਸ਼ੌਕ ਰੱਖਦੇ ਆ ਹਰੇਕ ਬੰਦੇ ਦੀ ਦਿਲਚਸਪੀ ਹੈਗੀ ਆ ਸਾਡਾ ਸੱਤ ਸਾਲ ਦਾ ਬੱਚਾ ਹੋਵੇ ਜਾਂ ਸਾਡੇ ਬਜ਼ੁਰਗ ਹੋਣ ਜਿਨ੍ਹਾਂ ਦੀ ਸੱਤਰ ਸਾਲ ਦੀ ਏਜ਼ ਹੈ ਤਾਂ ਉਹ ਸਾਰੇ ਇੰਟਰਸਟ ਰੱਖਦੇ ਆ ਅਸੀਂ ਕਰਦੇ ਰਹਿੰਦੇ ਹਾਂ ਇਹਦੇ 'ਚ ਮੰਮੀ ਨੂੰ ਤਾਂ ਮੇਰਿਆਂ ਨੂੰ ਖਾਸ ਬਹੁਤ ਸ਼ੌਕ ਆ ਕਾਫੀ ਜ਼ਿਆਦਾ ਗਮਲੇ ਉਹਨਾਂ ਨੇ ਨੀਚੇ ਲਗਾਏ ਹੋਏ ਆ ਉਹ ਨੋਲੇਜ ਵੀ ਠੀਕ ਠਾਕ ਰੱਖਦੇ ਕਿਉਂਕਿ ਸਾਡਾ ਪਿਛੋਕੜ ਖੇਤੀਬਾੜੀ ਵਾਲਾ ਸੀਗਾ ਪਿੱਛੇ ਨਾਨਕੇ ਪਰਿਵਾਰ ਤੋਂ ਦਾਦਕੇ ਪਰਿਵਾਰ 'ਚ ਵੀ ਸਾਰੇ ਖੇਤੀ ਕਰਦੇ ਅਤੇ ਪਰ ਦਾਦਾ ਜੀ ਜਿਵੇਂ ਨੌਕਰੀ ਪੇਸ਼ਾ ਸੀਗੇ ਤਾਂ ਬਾਕੀ ਮੇਰੇ ਤਾਇਆ ਜੀ ਚਾਚਾ ਜੀ ਨੌਕਰੀ ਪੇਸ਼ਾ ਤੇ ਤਾਂ ਇਸ ਕਰਕੇ ਉਹ ਖੇਤੀ ਦਾ ਉੱਧਰਲੇ ਪਾਸੇ ਤੋਂ ਰੁਝਾਨ ਘੱਟ ਹੈ ਪਿੰ ਨਾਨਕੇ ਵਾਲੇ ਪਾਸੇ ਤੋਂ ਥੋੜ੍ਹਾ ਜ਼ਿਆਦਾ ਹੈ ਤਾਂ ਅਸੀਂ ਗਰਾਉਂਡ ਫਲੋਰ ਅਤੇ ਉੱਪਰ ਫਸਟ ਫਲੋਰ 'ਤੇ ਦੋਨਾਂ ਪਾਸੇ ਉੱਪਰ ਗਮਲੇ ਲਗਾਏ ਹੋਏ ਆ ਬਾਕੀ ਥੋੜ੍ਹਾ ਬਹੁਤਾ ਪਰਿਆਵਰਨ ਦਿਵਸ ਜਿਵੇਂ ਹੁੰਦਾ ਉਹਦੇ 'ਚ ਵੀ ਕੋਈ ਐਕਟਿਵੀ ਆਉਂਦੀ ਆ ਕਦੇ ਬੱਚਿਆਂ ਨਾਲ ਕ ਸਕੂਲ ਦੇ ਵਿੱਚ ਕੁਝ ਕੰਮ ਕਰਨਾ ਉਹ ਕਹਿ ਦਿੰਦੇ ਸਾਨੂੰ ਪਰਿਆਵਰਨ ਦਿਵਸ ਦੇ ਉੱਪਰ ਤੁਸੀਂ ਕੁਝ ਪੌਦੇ ਲਗਾ ਕੇ ਫੋਟੋਆਂ ਭੇਜੋ ਤਾਂ ਅਸੀਂ ਉਹਨਾਂ ਦੇ ਸਕੂਲ 'ਚ ਕਰ ਲਈਦਾ ਜਾਂ ਕਿਸੇ ਮੰਦਰ ਗੁਰਦੁਆਰੇ 'ਚ ਜਾ ਕੇ ਲਗਾ ਲਈ ਦੇ ਆ ਤਾਂ ਇਸ ਤਰ੍ਹਾਂ ਕੁਝ ਨਾ ਕੁਝ ਅਸੀਂ ਕਰਦੇ ਰਹਿੰਦੇ ਹਾਂ